ਹੈਲੋ ਸਰ ਮੈਂ ਤੁਹਾਡੀ ਕੰਪਨੀ ਤੋਂ ਕੈਬ ਬੁੱਕ ਕੀਤੀ ਸੀ ਅਤੇ ਮੈਂ ਜਾਣਾ ਸੀਗਾ ਇੰਰਟਵਿਊ ਦੇਣ ਅਤੇ ਸਰ ਮੇਰੀ ਇੰਟਰਵਿਊ ਦਾ ਟਾਈਮ ਜਿਹੜਾ ਉਹ ਨੌਂ ਵਜੇ ਦਾ ਸੀਗਾ ਅਤੇ ਮੈਂ ਤੁਹਾਡੇ ਕੈਬ ਡਰਾਈਵਰ ਨੂੰ ਦੱਸਿਆ ਸੀਗਾ ਵੀ ਤੁਸੀਂ ਐਨੇ ਵਜੇ ਆ ਜਾਇਓ ਮਤਲਬ ਘੰਟਾ ਪਹਿਲਾਂ ਆ ਜਾਇਓ ਅੱਠ ਵਜੇ ਮੈਂ ਉਹਨੂੰ ਕਿਹਾ ਅਤੇ ਮੈਂ ਉਹਦੀ ਵੇਟ ਕੀਤੀ ਸਰ ਪੌਣੇ ਅੱਠ ਹੋ ਗਏ ਫੋਨ ਲਾਇਆ ਅਤੇ ਉਹ ਕਹਿੰਦਾ ਕੇ ਮੈਂ ਲੇਟ ਹਾਂ ਅਤੇ ਸਰ ਮੇਰਾ ਇੰਟਰਵਿਊ 'ਤੇ ਪਹੁੰਚਣਾ ਜ਼ਰੂਰੀ ਸੀ ਨੌਂ ਵਜੇ ਉੱਥੇ ਮੈਂ ਹਾਜ਼ਰ ਹੋਣਾ ਸੀਗਾ ਮੈਂ ਪੈਸੇ ਜੋ ਤੁਹਾਡੀਆਂ ਰਿਕੁਆਇਰਮੈਂਟਾਂ ਸਭ ਪੂਰੀਆਂ ਕਰਤੀਆਂ ਸੀ ਪੈਸੇ ਵੀ ਪਹਿਲਾਂ ਉਹ ਕਰਤੇ ਅਤੇ ਮੈਨੂੰ ਹੁਣ ਛੇਤੀ ਜਾਣਾ ਪੈਣਾ ਸਰ ਮੈਂ ਲੇਟ ਹਾਂ ਤਾਂ ਉਹ ਡਰਾਈਵਰ ਨੂੰ ਮੈਂ ਫੋਨ ਕੀਤਾ ਡਰਾਈਵਰ ਕਹਿੰਦਾ ਜੀ ਮੈਨੂੰ ਹਜੇ ਟੈਮ ਲੱਗੂਗਾ ਤੇ ਸਰ ਮੈਂ ਉਸ ਉਸਦੀ ਐਨੀ ਵੇਟ ਨਹੀਂ ਕਰ ਸਕਦੀ ਉਹਨੇ ਮੈਨੂੰ ਕਿਹਾ ਕੇ ਮੈਡਮ ਮੈਂ ਸਾਢੇ ਅੱਠ ਵਜੇ ਆਊਂਗਾ ਅਤੇ ਸਰ ਮੈਂ ਉੱਥੇ ਨੌਂ ਵਜੇ ਪਹੁੰਚਣਾ ਸਾਢੇ ਅੱਠ ਵਜੇ ਉਹ ਆਊਂਗਾ ਅਤੇ ਰਸਤਾ ਬਹੁਤ ਜ਼ਿਆਦਾ ਹੈ ਅਤੇ ਮੇਰੀ ਇੰਟਰਵਿਊ ਜ਼ਰੂਰੀ ਹੈ ਸਰ ਮੇਰੀ ਨੌਕਰੀ ਦਾ ਸਵਾਲ ਹੈ ਅਤੇ ਮੈਂ ਐਨਾ ਇੰਤਜ਼ਾਰ ਉਹਦਾ ਨਹੀਂ ਕਰ ਸਕਦੀ ਅਤੇ ਸੋ ਜਿਹੜੀ ਮੈਂ ਪੇਮੈਂਟ ਕੀਤੀ ਹੈ ਸਰ ਅਡਵਾਂਸ 'ਚ ਅਤੇ ਉਹ ਤੁਸੀਂ ਮੈਨੂੰ ਵਾਪਿਸ ਕਰ ਦਿਓ ਅਤੇ ਮੈਂ ਜਿਹੜੀ ਕੈਬ ਹੈ ਉਹ ਮੁਲਤਵੀ ਕਰਨਾ ਚਾਹੁੰਦੀ ਹਾਂ ਰੱਦ ਕਰਨਾ ਚਾਹੁੰਦੀ ਹਾਂ ਮੈਂ ਕੈਬ 'ਤੇ ਨਹੀਂ ਜਾਣਾ ਚਾਹੁੰਦੀ ਸਰ ਕਿਉਂਕਿ ਮੈਂ ਛੇਤੀ ਜਾਣਾ ਤਾਂ ਮੈਂ ਆਪਣੇ ਘਰ ਫੋਨ ਕੀਤਾ ਅਤੇ ਗੱਡੀ ਮੰਗਵਾਈ ਆ ਅਤੇ ਮੈਂ ਉੱਥੇ ਜਲਦੀ ਪਹੁੰਚਣਾ ਸੋ ਕਿਰਪਾ ਹੋਊਗੀ ਸਰ ਕੇ ਤੁਸੀਂ ਜਿਹੜਾ ਮੈਂ ਅਡਵਾਂਸ ਤੁਹਾਨੂੰ ਦਿੱਤਾ ਹੈ ਤਾਂ ਉਹ ਮੇਰਾ ਅਡਵਾਂਸ ਤੁਸੀਂ ਮੋੜ ਦਿਓ ਅਤੇ ਤੁਸੀਂ ਆਪਣੇ ਡਰਾਈਵਰ ਨੂੰ ਵੀ ਪੁੱਛੋ ਵੀ ਜਦੋਂ ਮੈਂ ਕੈਬ ਪਹਿਲਾਂ ਬੁੱਕ ਕੀਤੀ ਜਦੋਂ ਉਹਨੂੰ ਮੈਂ ਓਡਰ ਕ ਕੀਤਾ ਅਤੇ ਉਹਨੇ ਮੈਨੂੰ ਉਦੋਂ ਕਿਹਾ ਸੀ ਕੇ ਮੈਂ ਟੈਮ ਸਿਰ ਪਹੁੰਚ ਜਾਊਂ ਪਰ ਸਰ ਬਾਅਦ ਵਿੱਚ ਉਹਨੇ ਮੈਨੂੰ ਮਨਾਂ ਕਿਉਂ ਕੀਤਾ ਇੱਦਾਂ ਸਰ ਖਰਾਬ ਹੋ ਜ਼ਾ ਮੇਰੀ ਇੰਟਰਵਿਊ ਸੀਗੀ ਅਤੇ ਬੜੀ ਨਮੋਸ਼ੀ ਹੁੰਦੀ ਹੈ ਇੱਦਾਂ ਤੁਸੀਂ ਪਲੀਸ ਉਸ ਡਰਾਈਵਰ ਨੂੰ ਪੁੱਛੋਂ ਕੇ ਉਹ ਦੇਰੀ ਕਿਉਂ ਹੋਈ ਹੈ ਉਹਨੂੰ ਅਤੇ ਜਿੱਥੋਂ ਤੱਕ ਹੋ ਸਕੇ ਸਰ ਮੇਰਾ ਬੈਲੇਂਸ ਤੁਸੀਂ ਜਲਦੀ ਵਾਪਿਸ ਕਰ ਦਿਓ ਮੈਂ ਕੈਬ ਰੱਦ ਕਰਦੀ ਹਾਂ ਅਤੇ ਮੈਂ ਕਿਸੇ ਹੋਰ ਜ਼ਰੀਏ ਇੰਟਰਵਿਊ 'ਤੇ ਪਹੁੰਚਣਾ ਹੈ ਆਪਣੇ ਸਥਾਨ 'ਤੇ ਧੰਨਵਾਦ